ਸਾਡੇ ਫੁੱਲਾਂ ਦੇ ਬਾਗ ਅਤੇ ਫਲਾਂ ਦੇ ਬਾਗ ਆ ਅਸੀਂ ਵੀਹ ਕਿੱਲਿਆਂ 'ਚ ਫਲਾਂ ਫਲ ਲਾਏ ਹੋਏ ਆ ਅਤੇ ਦਸ ਕਿੱਲਿਆਂ 'ਚ ਫੁੱਲਾਂ ਦਾ ਬਾਗ ਲਾਇਆ ਹੋਇਆ ਅਤੇ ਸਾਡੇ ਫੁੱਲ ਅਲੱਗ ਅਲੱਗ ਮੰਡੀਆਂ 'ਚ ਜਾਂਦੇ ਆ ਸੁਬਹਾ ਗੱਡੀ ਭਰ ਕੇ ਅਤੇ ਅਲੱਗ ਅਲੱਗ ਦੁਕਾਨਾਂ 'ਤੇ ਸਪਲਾਈ ਕਰਦੇ ਹਾਂ ਸਾਡੀ ਖੁਦ ਦੀ ਵੀ ਸ਼ੋਪ ਹੈ ਅਸੀਂ ਉੱਥੇ ਬੁੱਕੇ ਤਿਆਰ ਕਰਕੇ ਬੁੱਕੇ ਵੇਚਦੇ ਹਾਂ ਇਹ ਸਾਡੇ ਫੁੱਲ ਗੁਰੂ ਘਰਾਂ ਦੇ ਸਜਾਵਟ ਲਈ ਵੀ ਜਾਂਦੇ ਆ ਸਟੇਜਾਂ ਦੀ ਸਜਾਵਟ ਵਾਸਤੇ ਵੀ ਜਾਂਦੇ ਆ ਅਤੇ ਫਲ ਸਾਡੇ ਸਾਡੇ ਅੰਗੂਰਾਂ ਦੇ ਬਾਗ ਆ ਅਤੇ ਕਿੰਨੂਆਂ ਦਾ ਬਾਗ ਆ ਅਤੇ ਬੇਰ ਬੇਰੀਆਂ ਲੱਗੀਆਂ ਹੋਈਆਂ ਆ ਅਤੇ ਸਾਡੇ ਫਰੂਟ ਜਿਹੜੇ ਮੰਡੀਆਂ ਦੇ ਵਿੱਚ ਜਾਂਦੇ ਆ ਸਬਜ਼ੀ ਮੰਡੀਆਂ 'ਚ ਜਾਂਦੇ ਆ ਅਤੇ ਫਰੂਟ ਸਾਡੇ ਵਿਆਹਾਂ ਸ਼ਾਦੀਆਂ 'ਚ ਵੀ ਜਾਂਦੇ ਆ ਚਾਟ ਪਕਾਈ ਜਾਂਦੀ ਆ ਅਤੇ ਫਰੂਟ ਅਸੀਂ ਖੁਦ ਵੀ ਸਾਡੀਆਂ ਗੱਡੀਆਂ ਭਰ ਕੇ ਮੰਡੀ ਦੇ ਵਿੱਚ ਭੇਜਦੇ ਹਾਂ ਅਸੀਂ ਅਲੱਗ ਅਲੱਗ ਹੋਰ ਸਟੇਟ 'ਚ ਵੀ ਜਾਂਦੀਆਂ ਹੈਗੀਆਂ ਅਤੇ ਕਿੰਨੂ ਸਾਡੇ ਉਹ ਕਾਫੀ ਦੂਰ ਤੱਕ ਜਾਂਦੇ ਆ ਅਤੇ ਅਸੀਂ ਫਰੁ ਫਰੂਟ ਜਿਵੇਂ ਕੋਈ ਮਤਲਬ ਕੰਪਨੀ 'ਚ ਵੀ ਭੇਜਦੇ ਹਾਂ ਜਿੱਥੇ ਮਤਲਬ ਡਰਿੰ ਜੂਸ ਵਗੈਰਾ ਤਿਆਰ ਹੁੰਦਾ ਹੈਗਾ ਅਸੀਂ ਫਰੂਟ ਉੱਥੇ ਵੀ ਭੇਜਦੇ ਹਾਂ ਆਪਦਾ ਤਕਰੀਬਨ ਸਾਡਾ ਜਿੰਨਾ ਵੀ ਫਰੂਟ ਆ ਵਧੀਆ ਕੁਆਲਿਟੀ ਦਾ ਹੁੰਦਾ ਹੈਗਾ ਇਸ ਕਰਕੇ ਸਾਡੀ ਮਾਰਕੀਟ ਬਣੀ ਹੋਈ ਆ ਦੂਰ ਦੂਰ ਤੱਕ ਫਰੂਟ ਜਾਂਦਾ ਸਾਡਾ ਅਤੇ ਫੁੱਲ ਵੀ ਸਾਡੇ ਸਾਰੀਆਂ ਸਜਾਵਟਾਂ ਵਾਸਤੇ ਦੂਰ ਦੂਰ ਤੱਕ ਮੰਡੀਆਂ ਮੰਡੀਆਂ ਤੱਕ ਜਾਂਦੇ ਆ